ਜੇ ਆਪਾਂ ਸੰਗੀਤ ਦੀ ਗੱਲ ਕਰੀਏ ਤਾਂ ਜਿਹੜਾ ਸ਼ਾਸਤਰੀ ਸੰਗੀਤ ਹੈ ਨਾ ਉਹ ਤਾਂ ਧੁਰਾ ਹੈ ਸੰਗੀਤ ਦਾ ਕਿ ਉਹ ਤੋਂ ਬਗੈਰ ਤਾਂ ਆਪਾਂ ਇੱਕ ਗਾਇਕ ਦੀ ਹੋਂਦ ਮੈਂ ਕਿਹਾ ਇਮੈਜਨ ਆਪਾਂ ਕਰ ਨਹੀਂ ਸਕਦੇ ਸੋਚ ਨਹੀਂ ਸਕਦੇ ਉਹਦੇ ਬਗੈਰ ਕਿਉਂਕਿ ਜੇ ਆਪਾਂ ਸ਼ਾਸਤਰੀ ਸੰਗੀਤ ਸਿੱਖਿਆ ਹੋਵੇਗਾ ਤਾਂ ਜਿਹੜੀ ਸੰਗੀਤ ਦੇ ਵਿੱਚ ਸੰਗੀਤ ਦੀਆਂ ਬਰੀਕੀਆਂ ਪਕੜਨੀਆਂ ਆਸਾਨ ਹੋ ਜਾਂਦੀਆਂ ਨੇ ਜਿਵੇਂ ਕਿ ਜਿਹੜੇ ਸਾਸ਼ਤਰੀ ਸੰਗੀਤ ਆਪਾਂ ਸੁਰ ਤੋਂ ਸ਼ੁਰੂ ਕਰਦੇ ਹਾਂ ਕਿ ਸਾ ਰੇ ਗਾ ਮਾ ਪਾ ਧਾ ਨੀ ਸਾ ਇਹ ਸੁਰ ਨੇ ਅਤੇ ਇਹਨਾਂ ਨੂੰ ਕਿਵੇਂ ਗਾਉਣਾ ਹੈ ਰਿਆਜ਼ ਕਿਵੇਂ ਕਰਨਾ ਹੈ ਮੇਰੇ ਉਸਤਾਦ ਜੀ ਕਹਿੰਦੇ ਸੀ ਇੱਕ ਸਾਹ ਹੁੰਦਾ ਇੱਕ ਸਾਹ ਹੁੰਦਾ ਦੋਨਾਂ ਰਿਆਜ਼ ਕਰਨਾ ਪੈਂਦਾ ਹੈ ਅਤੇ ਉਹ ਜੋ ਸਾ ਦਾ ਆਪਾਂ ਰਿਆਜ਼ ਕਰਦੇ ਹਾਂ ਆਪਣੇ ਜਿਹੜੇ ਗਲੇ ਦੀ ਆਵਾਜ਼ ਬਣਦੀ ਹੈ ਉਹ ਰਿਆਜ਼ ਨਾਲ ਹੀ ਬਣਦੀ ਹੈ ਅਤੇ ਇਹ ਜਿਹੜੀ ਚੀਜ਼ ਹੈ ਇਹ ਇੱਕ ਸ਼ਾਸਤਰੀ ਸੰਗੀਤ ਦਾ ਜਿਹੜਾ ਤੁਹਾਡਾ ਗੁਰੂ ਹੋਵੇਗਾ ਨਾ ਇਹ ਉਹੀ ਸਿਖਾਉਂਦਾ ਹੈ ਬਾਕੀ ਜਿਹੜੇ ਹੋਰ ਗਾਇਕ ਨੇ ਉਹ ਦੇਖਾ ਦੇਖੀ ਜਾਂ ਆਪਣੇ ਕੋਲੋਂ ਕਈਆਂ ਨੂੰ ਬਖਸ਼ਿਸ਼ ਹੁੰਦੀ ਹੈ ਕਹਿ ਦਉ ਪਰਮਾਤਮਾ ਦੀ ਉਹਨਾਂ ਨੂੰ ਪਹਿਲਾਂ ਤੋਂ ਹੀ ਥੋੜ੍ਹਾ ਬਹੁਤ ਗਲਾ ਸਾਫ ਹੁੰਦਾ ਹੈ ਤਾਂ ਗਾਉਣ ਲੱਗ ਜਾਂਦੇ ਹਨ ਪਰ ਮੇਰੇ ਸੋਚ ਦੇ ਵਿੱਚ ਇਹ ਹੈ ਕਿ ਬੰਦੇ ਨੂੰ ਸ਼ਾਸਤਰੀ ਸੰਗੀਤ ਤਾਂ ਸਿੱਖਣਾ ਚਾਹੀਦਾ ਹੈ ਹਾਲਾਂਕਿ ਮੁਸ਼ਕਿਲ ਇਹ ਹੈ ਕਿ ਰਿਆਜ਼ ਕਰਨਾ ਪੈਂਦਾ ਸਿੱਖਣਾ ਪੈਂਦਾ ਹੈ ਚੀਜ਼ ਪਰ ਜਿਹੜਾ ਸਿੱਖ ਲੈਂਦਾ ਹੈ ਉਹਦੀ ਗਾਇਕੀ 'ਚ ਨਿਖਾਰ ਆਉਂਦਾ ਹੈ ਅਤੇ ਉਹਨੂੰ ਗਾਇਕੀ ਦੀਆਂ ਅੱਗੇ ਜਿਹੜੀਆਂ ਹੋਰ ਬਰੀਕੀਆਂ ਉਹ ਪਤਾ ਲੱਗਦਾ ਅਤੇ ਗਾਉਣਾ ਸੌਖਾ ਹੋ ਜਾਂਦਾ